ਪੰਜਾਬ ਵਿੱਚ ਹੁਣ ਦੇਖਿਆ ਜਾਏ ਤਾਂ ਪਾਣੀ ਦੀ ਸਮੱਸਿਆ ਇੰਨੀ ਨਹੀਂ ਹੈ ਕਿਉਂਕਿ ਹਰ ਥਾਂ 'ਤੇ ਟਿਊਬਵੈਲਾਂ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕੀ ਹੈ ਜਿੱਥੇ ਵੀ ਜ਼ਮੀਨ 'ਚੋਂ ਪਾਣੀ ਕੱਢ ਕੇ ਫਸਲਾਂ ਲਈ ਹਰ ਵਕਤ ਮੁਹੱਈਆ ਕਰਵਾ ਸਕਦੇ ਹਨ ਅਤੇ ਵਾਕਈ ਖੇਤੀਬਾੜੀ ਵਿਭਿੰਨਤਾ ਦੇ ਉਤਸ਼ਾਹ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵਿੱਚ ਵਿਭਿੰਨਤਾ ਨਾਲ ਦੇਖਿਆ ਜਾਵੇ ਤਾਂ ਜ਼ਿਆਦਾ ਪਾਣੀ ਨਾ ਲੈਣ ਵਾਲੀਆਂ ਫਸਲਾਂ 'ਤੇ ਹੀ ਫੋਕਸ ਕੀਤਾ ਜਾ ਰਿਹਾ ਕਿਉਂਕਿ ਪਹਿਲਾਂ ਤੋਂ ਵਿਕ ਰਹੀਆਂ ਚੌਲ ਜਾਂ ਫਿਰ ਆਪਣੀ ਕਣਕ ਇਹਨਾਂ ਤੋਂ ਵਿਭਿੰਨ ਹੋਣਾ ਹੀ ਇਹ ਪ੍ਰੋਜੈਕਟ ਦਾ ਮੁੱਖ ਕਾਰਨ ਹੈ ਅਤੇ ਇਹਨਾਂ ਦੇ ਪਾਣੀ ਲਈ ਸੋਰਸ ਉਹੀ ਹਨ ਅਤੇ ਨਹਿਰੀ ਪਾਣੀ ਨੂੰ ਵੀ ਉਹਦੇ ਵਿੱਚ ਉਹ ਕੀਤਾ ਯੂਸ ਕੀਤਾ ਜਾ ਰਿਹਾ ਨਹਿਰੀ ਪਾਣੀ ਨੂੰ ਖੇਤਾਂ ਤੱਕ ਲੈ ਕੇ ਆਉਣਾ ਬਾਕੀ ਕਨਾਲ ਬਣਾਉਣੇ ਇਹ ਚੀਜ਼ਾਂ ਕਈ ਪਿੰਡਾਂ ਵਿੱਚ ਪਹੁੰਚ ਚੁੱਕੀਆਂ ਹਨ ਅੱਗੇ ਇਹਨਾਂ ਨੂੰ ਹੋਰ ਸਾਰੇ ਕਿੱਧਰ ਤੱਕ ਮੁਹੱਈਆ ਕਰਾਇਆ ਜਾਏ ਸਰਕਾਰ ਵੱਲੋਂ ਅਤੇ ਇਹ ਖੇਤੀਬਾੜੀ ਵਿਭਿੰਨਤਾ ਉਤਸ਼ਾਹ ਨੂੰ ਪ੍ਰਦਰਸ਼ਨ ਕਰ ਰਹੇ ਹਾਂ